ਖੇਡਾਂ ਖੇਡਣ ਨਾਲ ਪੇਂਡੂ ਖੇਤਰ ਨੂੰ ਬਹੁਤ ਜ਼ਿਆਦਾ ਤਾਂ ਨਹੀਂ ਪਰ ਸੀਮਤ ਮਾਤਰਾ ਵਿੱਚ ਹੀ ਲਾਭ ਹੁੰਦੇ ਹਨ ਜਿਵੇਂ ਕਿ ਲੋਕ ਖੇਡਾਂ ਖੇਡਣ ਲਈ ਬਹੁਤ ਦੂਰੋਂ ਦੂਰੋਂ ਆਉਂਦੇ ਹਨ ਸਾਡੇ ਇੱਥੇ ਨਾਲ ਹੀ ਪਿੰਡ ਬੁਰਜ ਜਿੱਥੇ ਕਿ ਛਿੰਝ ਮਨਾਈ ਜਾਂਦੀ ਹੈ ਜਿੱਥੇ ਕਿ ਕੁਸ਼ਤੀ ਦਾ ਦੰਗਲ ਕਰਵਾਇਆ ਜਾਂਦਾ ਹੈ ਅਤੇ ਲੋਕ ਇੱਥੇ ਪਹਿਲਵਾਨ ਦੂਰੋਂ ਦੂਰੋਂ ਆਉਂਦੇ ਹਨ ਜੋ ਕਿ ਚੋਟੀ ਦੇ ਖਿਡਾਰੀ ਹਨ ਅਤੇ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦਾ ਰਹਿਣ ਸਹਿਣ ਪੁੱਛਦੇ ਹਨ ਅਤੇ ਉਨ੍ਹਾਂ ਦੇ ਕਲਚਰ ਬਾਰੇ ਵੀ ਪੁੱਛਦੇ ਹਨ ਅਤੇ ਇੱਥੋਂ ਤੱਕ ਕਿ ਉਹ ਇਹਨਾਂ ਦੀ ਨਿਮਰਤਾ ਐਨੀ ਹੁੰਦੀ ਹੈ ਕਿ ਐਡੇ ਬੜੇ ਮੇਲੇ ਵਿੱਚ ਜੇ ਉਹਨਾਂ ਨੂੰ ਕੋਈ ਕਹਿ ਦੇਵੇ ਕਿ ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ ਤਾਂ ਉਹ ਜਵਾਬ ਨਹੀਂ ਦਿੰਦੇ ਜਿੱਥੋਂ ਕਿ ਪਤਾ ਲੱਗਦਾ ਹੈ ਕਿ ਸਾਨੂੰ ਵੀ ਉਹਨਾਂ ਵਰਗੇ ਬਣਨਾ ਚਾਹੀਦਾ ਹੈ ਜੋ ਕਿ ਸਾਰਿਆਂ ਲਈ ਟਾਈਮ ਕੱਢਦੇ ਹਨ ਅਤੇ ਆਪਸ ਵਿੱਚ ਗੱਲਬਾਤ ਕਰਨ ਨਾਲ ਸਾਡਾ ਆਪਸੀ ਰੁਝਾਨ ਵੱਧਦਾ ਹੈ